ਮੈਂ ਰਾਜਕੁਮਾਰ ਔਨਲਾਈਨ ਇੱਕ ਸ਼ੋਪਿੰਗ ਕੀਤੀ ਸੀ ਜੋ ਕਿ ਉਸ ਸ਼ੋਪਿੰਗ ਵਿੱਚ ਇੱਕ ਬੈਗ ਮੰਗਵਾਇਆ ਸੀ ਉਸ ਬੈਗ ਦਾ ਕਲਰ ਮੈਂ ਬਲੈਕ ਵਿੱਚ ਮੰਗਵਾਇਆ ਸੀ ਪਰ ਉਸ ਬੈਕ ਨੂੰ ਨੀਲੇ ਕਲਰ ਵਿੱਚ ਭੇਜ ਦਿੱਤਾ ਗਿਆ ਅਤੇ ਉਸਦਾ ਰੰਗ ਵੀ ਫਿੱਕਾ ਜਿਹਾ ਲੱਗ ਰਿਹਾ ਸੀ ਜਿਵੇਂ ਪੁਰਾਣਾ ਜਿਹਾ ਹੋਵੇ ਜਦ ਮੈਂ ਉਸਨੂੰ ਚੈੱਕ ਕੀਤਾ ਤਾਂ ਉਸਦੀ ਅੰਦਰਲੀ ਜੇਬ ਵੀ ਖਰਾਬ ਸੀ ਅਤੇ ਉਸਦੀਆਂ ਸਾਰੀਆਂ ਜਿੱਪਾਂ ਖਰਾਬ ਨਿਕਲੀਆਂ ਹਨ ਅਤੇ ਉਸ ਬੈਗ ਵਿੱਚ ਐਵੇਂ ਲੱਗ ਰਿਹਾ ਸੀ ਜਿਵੇਂ ਫਟੀਆਂ ਲੀਰਾਂ ਪਾਈਆਂ ਹੋਣ ਉਹ ਬੈਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਜਿਵੇਂ ਉਸਨੂੰ ਢੇਰ ਤੋਂ ਚੱਕ ਕੇ ਲਿਆਂਦਾ ਹੋਵੇ ਉਹ ਬੈਕ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ